ਮੈਨੂੰ ਨਾ ਬਰੱਸ਼ਿਜ ਦੀ ਲੋੜ ਸੀਗੀ ਜਿਹੜੇ ਪੇਂਟਿੰਗ ਵਿੱਚ ਬਰੱਸ਼ ਯੂਜ਼ ਹੁੰਦੇ ਹੈ ਪਹਿਲਾਂ ਤਾਂ ਮੈਂ ਕੌਲਜ ਦੇ ਵਿੱਚ ਉਹੀ ਯੂਜ਼ ਕਰਦੀ ਸੀ ਤਾਂ ਮੈਨੂੰ ਆਪਣੇ ਲੈਣ ਦੀ ਲੋੜ ਨਹੀਂ ਪੈਂਦੀ ਸੀ ਪਰ ਹੁਣ ਮੇਰਾ ਕੌਲਜ ਖਤਮ ਹੋਣ ਵਾਲਾ ਏ ਤਾਂ ਮੈਨੂੰ ਹੁਣ ਆਪਣੇ ਬਰੱਸ਼ ਦੀ ਲੋੜ ਹੈ ਤਾਂ ਮੈਂ ਪਹਿਲਾਂ ਤਾਂ ਦੁਕਾਨਾਂ ਵਗੈਰਾ 'ਤੇ ਪੁੱਛੇ ਸੀਗੇ ਉੱਥੇ ਮੈਨੂੰ ਵਧੀਆ ਕੁਆਲਿਟੀ ਦੇ ਨਹੀਂ ਮਿਲੇ ਤਾਂ ਮੈਂ ਸੋਚਿਆ ਕਿ ਔਨਲਾਈਨ ਬਰੱਸ਼ ਮੰਗਵਾ ਲੈਂਦੀ ਹਾਂ ਤਾਂ ਮੈਂ ਔਨਲਾਈਨ ਬਰੱਸ਼ ਦੇਖਣੇ ਸ਼ੁਰੂ ਕੀਤੇ ਮੈਂ ਐਮਾਜ਼ੋਨ 'ਤੇ ਇੱਕ ਔਨਲਾਈਨ ਬਰੱਸ਼ ਦੇਖੇ ਰਾਊਂਡ ਬਰੱਸ਼ ਸੀ ਸੋਫਟ ਰਾਊਂਡ ਬਰੱਸ਼ ਅਤੇ ਮੈਨੂੰ ਉਹ ਥੋੜ੍ਹੇ ਮੈਨੂੰ ਉਹ ਥੋੜ੍ਹੇ ਚੰਗੇ ਜਿਹੇ ਲੱਗੇ ਦੇਖਣ 'ਚ ਵੀ ਸੋਹਣੇ ਲੱਗ ਰਹੇ ਸੀ ਫੋਟੋ ਵਿੱਚ ਦੈਨ ਮੈਂ ਉਹਦਾ ਰੇਟ ਵਗੈਰਾ ਦੇਖਿਆ ਤਾਂ ਰੇਟ ਵੀ ਮਤਲਬ ਬਹੁਤ ਜ਼ਿਆਦਾ ਘੱਟ ਰੇਟ ਸੀਗਾ ਵੈਸੇ ਤਾਂ ਉਦਾਂ ਦੇ ਬਰੱਸ਼ ਜਿੰਨਾ ਕੁ ਮੈਨੂੰ ਪਤਾ ਕਾਫੀ ਮਹਿੰਦੇ ਆਉਂਦੇ ਹੈ ਪਰ ਉੱਥੇ ਬਹੁਤ ਘੱਟ ਰੇਟ ਸੀ ਤਾਂ ਮੈਂ ਸੋਚਿਆ ਕਿ ਮੰਗਵਾ ਲਵਾਂ ਬਟ ਮੈਨੂੰ ਥੋੜ੍ਹਾ ਡਰ ਵੀ ਸੀ ਕਿ ਜੇ ਪਤਾ ਦੀ ਕਿੱਦਾਂ ਦੇ ਹੋਊਂਗੇ ਜਦ ਹੱਥ ਵਿੱਚ ਆਊਂਗੇ ਬਟ ਮੈਂ ਮੰਗਵਾ ਲਏ ਓਡਰ ਕਰ ਦਿੱਤਾ ਅਤੇ ਹਫਤੇ ਕੁ ਬਾਅਦ ਉਹਦਾ ਓਡਰ ਆਇਆ ਅਤੇ ਜਦ ਮੈਂ ਉਹ ਬਰੱਸ਼ ਦੇਖੇ ਖੋਲ੍ਹ ਕੇ ਦੇਖੇ ਤਾਂ ਮੈਨੂੰ ਬਹੁਤ ਜ਼ਿਆਦਾ ਅੱਛੇ ਲੱਗੇ ਉਹ ਬਰੱਸ਼ ਬਹੁਤ ਅੱਛੀ ਕੁਆਟਿਲੀ ਦੇ ਸੀਗੇ ਇਨ ਜਦ ਮੈਂ ਉਹਦੇ ਨਾਲ ਪੇਂਟਿੰਗ ਕੀਤੀ ਤਾਂ ਪੇਂਟਿੰਗ ਵੀ ਉਹਦੇ ਨਾਲ ਬਹੁਤ ਜ਼ਿਆਦਾ ਅੱਛੀ ਹੋਈ ਮੈਨੂੰ ਉਹ ਬਰੱਸ਼ ਯੂਜ਼ ਕਰਕੇ ਬਹੁਤ ਜ਼ਿਆਦਾ ਚੰਗਾ ਲੱਗਿਆ